ਹੈਲੋ ਹਾਂ ਅਰਸ਼ ਕਿੱਦਾਂ ਮੈਂ ਤਾਂ ਬਿਲਕੁਲ ਨਹੀਂ ਵਧੀਆ ਯਾਰ ਮੈਨੂੰ ਨਹੀਂ ਪਤਾ ਕਿ ਪੰਜਾਬ 'ਚ ਇੰਨੀ ਜ਼ਿਆਦਾ ਠੰਡ ਆ ਹਾਂ ਉਹ ਯਾਰ ਮੈਂ ਦੋ ਦਿਨ ਪਹਿਲਾਂ ਹੀ ਹਲੇ ਆਈ ਹਾਂ ਮਤਲਬ ਬੋਂਬੇ 'ਚ ਤਾਂ ਇੰਨੀ ਠੰਡ ਹੁੰਦੀ ਨਹੀਂ ਆ ਨੋਰਮਲ ਹੀ ਟੈਂਪਰੇਚਰ ਰਹਿੰਦਾ ਏ ਸਰਦੀ ਗਰਮੀ ਮਿਕਸ ਦਾ ਅਤੇ ਇੱਥੇ ਤਾਂ ਅੰਤਾਂ ਦੀ ਠੰਡ ਪਈ ਹੋਈ ਆ ਨਹੀਂ ਯਾਰ ਮੈਨੂੰ ਥੋੜ੍ਹੀ ਪਤਾ ਸੀ ਪੰਜਾਬ 'ਚ ਇੰਨੀ ਠੰਡ ਹੋਵੇਗੀ ਮੈਂ ਤਾਂ ਮੁੰਬਈ ਦੇ ਹਿਸਾਬ ਨਾਲ਼ ਹੀ ਕੱਪੜੇ ਲੈ ਆਉਂਦੇ ਆ ਪਤਲੇ ਪੁਤਲੇ ਕੱਪੜੇ ਹੁਣ ਮੈਂ ਕਰਾਂ ਕੀ ਮੈਨੂੰ ਤਾਂ ਸਮਝ ਹੀ ਨਹੀਂ ਆਉਣ ਡਿਆ ਹਾਂ ਹਾਂ ਯਾਰ ਸੱਚੀ ਇਹ ਤਾਂ ਬਹੁਤ ਹੀ ਵਧੀਆ ਵਾ ਮਤਲਬ ਮੈਨੂੰ ਜ਼ਿਆਦਾ ਪੰਜਾਬ ਦੀਆਂ ਸ਼ੋਪ ਵਗੈਰਾ ਦਾ ਪਤਾ ਵੀ ਨਹੀਂ ਤੂੰ ਹੈਲਪ ਕਰ ਦੇਂਗੀ ਤਾਂ ਕਾਫ਼ੀ ਵਧੀਆ ਰਹੂ ਨਹੀਂ ਯਾਰ ਪਤਾ ਮੇਰੀ ਤਾਂ ਤਬੀਅਤ ਵੀ ਬਹੁਤ ਖ਼ਰਾਬ ਹੋ ਗਈ ਤੇਰਾ ਕੋਈ ਫੈਮਲੀ ਡਾਕਟਰ ਹੈਗਾ ਤਾਂ ਮੈਨੂੰ ਸੁਜੈਸਟ ਕਰ ਦੇ ਚੱਲ ਯਾਰ ਥੈਂਕਸ ਬਹੁਤ ਵਧੀਆ ਕੀਤਾ ਤੂੰ ਥੈਂਕ ਯੂ ਹਾਂ ਓਕੇ